ਸਤਿ ਸ਼੍ਰੀ ਅਕਾਲ ਅਜੇ ਪੰਜਾਬ ਵਿੱਚ ਸੈਲਾਨੀਆਂ ਨੂੰ ਇਤਿਹਾਸ ਦੇ ਬਾਰੇ ਜਾਣਨਾ ਹੋਵੇ ਤਾਂ ਇਸ ਲਈ ਕਈ ਸਾਰੀ ਪ੍ਰਤਿਯੋਗਿਤਾ ਕਰਾਈ ਜਾ ਸਕਦੀ ਆ ਉਹਨਾਂ ਨੂੰ ਐਨੀਮੇਸ਼ਨ ਵੀਡੀਓ ਦਿਖਾਈ ਜਾ ਸਕਦੀ ਆ ਅੱਜ ਕੱਲ੍ਹ ਤਾਂ ਵੈਸੇ ਗੁਰਦੁਆਰਿਆਂ ਵਿੱਚ ਜਗ੍ਹਾ ਜਗ੍ਹਾ 'ਤੇ ਅਜਾਇਬ ਘਰ ਦਿੱਤੇ ਹੋਏ ਹੈ ਜਿੱਥੇ ਗੁਦੁ ਗੁਰਦੁਆਰਿਆਂ ਦੀ ਇਤਿਹਾਸ ਦੇ ਬਾਰੇ ਦੱਸਿਆ ਹੁੰਦਾ ਕਿ ਇਹ ਕਿਸ ਲਈ ਮਨਾਇਆ ਗਿਆ ਸੀ ਅਤੇ ਇਸ ਤੋਂ ਜੁੜਿਆ ਪਿੱਛੇ ਦੀ ਕੀ ਘਟਨਾ ਅਤੇ ਇਤਿਹਾਸ ਹੈਗਾ ਜਿਹਦੇ ਕਿ ਹਰਮਿੰਦਰ ਸਾਹਿਬ 'ਚ ਅਸੀਂ ਦੇਖਦੇ ਹਾਂ ਜਗ੍ਹਾ ਜਗ੍ਹਾ 'ਤੇ ਇਹਨਾਂ ਨੇ ਲੋਹੇ ਦੇ ਬੋਰਡ ਬਣਾਏ ਹੋਏ ਆ ਜਿੱਥੇ ਲਿਖਿਆ ਆਉਂਦਾ ਏ ਕਿ ਬਰਗਦ ਦਾ ਪੇੜ ਕਿੱਥੋਂ ਬਣਿਆ ਸੀ ਕਦੋਂ ਇਹਨਾਂ ਨੇ ਬਣਾਇਆ ਸੀ ਅਤੇ ਕਿਹੜਾ ਬਾਬਾ ਦੀਪ ਸਿੰਘ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਸੀਸ ਝੁਕਾਇਆ ਸੀਗਾ ਜਿੱਥੇ ਨਾਲੇ ਬਾਕੀ ਜੇ ਅਸੀਂ ਦੇਖੀਏ ਗੋਬਿੰਦਗੜ੍ਹ ਕਿਲਾ ਹੈਗਾ ਅੰਮ੍ਰਿਤਸਰ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਐਨੀਮੇਸ਼ਨ ਵੀਡੀਓ ਦਿਖਾਈ ਜਾਂਦੀ ਹੈ ਦਿਖਾਇਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਕਿੰਨੇ ਬਹਾਦੁਰ ਪੰਜਾਬ ਦੇ ਸਿੱਖ ਸਿੱਖ ਸੈਨਾਣੀ ਸੀਗੇ ਜੋ ਪੰਜਾਬ ਦਾ ਜਿਹਨਾਂ ਦਾ ਕਸਬਾ ਦੂਰ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀਗਾ ਮੈਂ ਬਸ ਇਹੀ ਕਹਿਣਾ ਚਾਹਵਾਂਗੀ ਕਿ ਬਈ ਤਰੀਕ ਤਰੀਕੇ ਬਹੁਤ ਸਾਰੇ ਹੈਗੇ ਆ ਜਿੱਥੇ ਸੈਲਾਨੀ ਇਤਿਹਾਸ ਬਾਰੇ ਜਾਣ ਸਕਦੇ ਆ ਚਾਰ ਸਾਹਿਬਜ਼ਾਦੇ ਜੋ ਇੱਕ ਚਿੱਤਰਕਾਰ ਇੱਕ ਮੂਵੀ ਦਿਖਾਈ ਗਈ ਹੈ ਉਹਦੇ ਵਿੱਚ ਪੰਜਾਬ ਦੇ ਇਤਿਹਾਸ ਬਾਰੇ ਦੱਸਿਆ ਗਿਆ ਹੈ ਕਿ ਕਿੱਦਾਂ ਗੁਰੂ ਸਾਹਿਬ ਜੀ ਨੇ ਆਪਣੇ ਚਾਰੋਂ ਪੁੱਤਰਾਂ ਨੂੰ ਆਪਣੇ ਤਿਆਗ ਕਰਤਾ ਸੀ ਧੰਨਵਾਦ ਜੀ